ਮੈਂ ਫ਼ਾਜ਼ਿਲਕਾ ਜ਼ਿਲ੍ਹਾ ਦਾ ਰਹਿਣ ਵਾਲਾ ਇੱਥੇ ਕਈ ਕਲਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਇੱਥੇ ਘੁਮਿਆਰ ਆਪਣੀ ਕਲਾ ਨਾਲ ਮਿੱਟੀ ਦੇ ਘੜੇ ਬਰਤਨ ਅਤੇ ਦੀਵੇ ਆਦਿ ਬਣਾਉਂਦੇ ਹਨ ਅਤੇ ਉਹਨਾਂ ਉੱਪਰ ਪੇਂਟਿੰਗ ਨਾਲ ਉਹਨਾਂ ਦੀ ਸਜ਼ਾਵਟ ਕਰ ਕੇ ਉਹਨਾਂ ਦੀ ਸ਼ੋਭਾ ਨੂੰ ਵਧਾਉਂਦੇ ਹਨ ਇੱਥੇ ਕਈ ਤਰ੍ਹਾਂ ਦੇ ਜੁਤੀਆਂ ਵੀ ਬਣਾਈਆਂ ਜਾਂਦੀਆਂ ਹਨ ਫ਼ਾ ਪੰਜਾਬ ਵਿਚ ਫ਼ਾਜ਼ਿਲਕਾ ਦੀ ਜੁੱਤੀ ਬੜੀ ਹੀ ਮਸ਼ਹੂਰ ਹੈ ਅਤੇ ਇੱਥੇ ਕਈ ਤਰ੍ਹਾਂ ਦੀ ਚਟਾਈਆਂ ਵੀ ਬਣਾਈਆਂ ਜਾਂਦੀਆਂ ਹਨ ਜੋ ਕਿ ਪੂਰੇ ਭਾਰਤ ਵਿੱਚ ਵਰਤੋਂ ਕੀਤੀ ਜਾਂਦੀ ਹੈ